ਜੀ ਅੱਜ ਆਪਾਂ ਗੱਲ ਕਰਾਂਗੇ ਸਰਕਾਰ ਨੂੰ ਆਪਣੇ ਪਿੰਡ ਸ਼ਹਿਰ ਜਾਂ ਕਸਬੇ ਜੋ ਵੀ ਹੈ ਚਲੋ ਸਿਹਤ ਸੰਭਾਲ ਲਈ ਆਵਾਜਾਈ ਸਿੱਖਿਆ ਆਦਿ ਦੇ ਲਈ ਲਈ ਮਤਲਬ ਕੀ ਕਰਨਾ ਚਾਹੀਦਾ ਸਰਕਾਰ ਨੂੰ ਸਰਕਾਰ ਨੂੰ ਪਹਿਲਾਂ ਗਰਾਊਂਡ ਲੈਵਲ 'ਤੇ ਇਹ ਚੀਜ਼ ਦੇਖਣੀ ਚਾਹੀਦੀ ਹੈ ਵੀ ਕਿਸ ਪਿੰਡ ਦੇ ਵਿੱਚ ਕਿਸ ਸ਼ਹਿਰ ਦੇ ਵਿੱਚ ਕਿਸ ਚੀਜ਼ ਦੀ ਯੋਗਤਾ ਹੈ ਆਪਣੀਆਂ ਮੁੱਖ ਬੁਨਿਆਦੀ ਲੋੜਾਂ ਇਹੀ ਹਨ ਕਿ ਜਿਵੇਂ ਸਿਹਤ ਸੰਭਾਲ ਹੋ ਗਈ ਐਜੂਕੇਸ਼ਨ ਹੋ ਗਈ ਅਤੇ ਆਵਾਜਾਈ ਹੋ ਗਈ ਜੇ ਇਹੀ ਤਿੰਨੇ ਚੀਜ਼ਾਂ ਵਧੀਆ ਹੋਣਗੀਆਂ ਤਾਂ ਹੀ ਆਪਾਂ ਆਪਣੇ ਸ਼ਹਿਰ ਦਾ ਵਿਕਾਸ ਦੇਖ ਸਕਦੇ ਹਾਂ ਤਾਂ ਹੀ ਆਪਾਂ ਫਾਰਵਡ ਹੋ ਸਕਦੇ ਹਾਂ ਅਦਰਵਾਈਜ਼ ਇਹ ਚੀਜ਼ਾਂ ਦੇ ਵਿੱਚ ਆਪਾਂ ਬੈਕਵਰਡ ਚੱਲਦੇ ਹਾਂ ਆਪਾਂ ਇਗਜਾਮਪਲ ਦੇ ਚੋ ਤੌਰ 'ਤੇ ਲੈ ਚਲਦੇ ਹਾਂ ਜਿਵੇਂ ਅਮਰੀਕਾ ਹੋ ਗਿਆ ਉਹਦੇ ਵਿੱਚ ਕੀ ਹੈਗਾ ਜੇ ਸੜਕਾਂ ਵਧੀਆ ਨੇ ਆਵਾਜਾਈ ਵਧੀਆ ਉੱਥੋਂ ਦਾ ਐਜੂਕੇਸ਼ਨ ਸਿਸਟਮ ਵਧੀਆ ਉੱਥੋਂ ਦੇ ਸਿਹਤ ਸੰਭਾਲ ਦੇ ਸਿਸਟਮ ਵਧੀਆ ਮਤਲਬ ਮੈਡੀਕਲ ਜ਼ਿਆਦਾ ਮਿਲਦੇ ਆ ਲੋਕਾਂ ਨੂੰ ਸਰਵਿਸਿਜ਼ ਮਤਲਬ ਐਟ ਦੀ ਸਪੋਟ ਜੋ ਵੀ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈਗੀ ਤਾਂ ਉਹਨਾਂ ਦਾ ਉਸ ਐਟ ਦੀ ਸਪੋਟ ਕੰਮ ਕੀਤਾ ਜਾਂਦਾ ਹੈਗਾ ਤਾਂ ਉੱਥੋਂ ਦਾ ਸਿਸਟਮ ਕਿਉਂ ਵਧੀਆ ਉੱਥੋਂ ਦੀਆਂ ਸਰਕਾਰਾਂ ਵਧੀਆਂ ਨੇ ਉੱਥੋਂ ਦੀ ਸਰਕਾਰਾਂ ਨੇ ਉੱਥੋਂ ਦੇ ਸਿਸਟਮ ਨੂੰ ਬਿਹਤਰ ਬਣਾਉਣ ਦੇ ਲਈ ਯੋਗਦਾਨ ਪਾਇਆ ਹੋਇਆ ਹੈ ਇਸੇ ਤਰ੍ਹਾਂ ਹੀ ਆਪਣੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਿਸਟਮ ਨੂੰ ਗਰਾਊਂਡ ਲੈਵਲ 'ਤੇ ਚੈੱਕ ਕਰਨ ਜੋ ਵੀ ਜਿੱਥੇ ਜ਼ਰੂਰਤਾਂ ਕਿਸੇ ਵੀ ਪਿੰਡ ਸ਼ਹਿਰ ਕਸਬੇ ਦੇ ਵਿੱਚ ਜ਼ਰੂਰਤ ਹੈ ਕਿਸੇ ਚੀਜ਼ ਦੀ ਤਾਂ ਉਹ ਮੁਹੱਈਆ ਕਰਵਾਉਣ ਤਾਂ ਜੋ ਆਪਣੇ ਦੇਸ਼ ਦਾ ਅੱਗੇ ਜਾ ਕੇ ਸੁਧਾਰ ਹੋ ਸਕੇ ਅਤੇ ਇਹ ਫੋਰਵਰਡ ਹੋ ਸਕੇ